ਸਤਿ ਸ਼੍ਰੀ ਅਕਾਲ ਜੀ ਮੈਂ ਨਾ ਆਪਣੇ ਘਰ ਦੇ ਵਿੱਚ ਫੰਕਸ਼ਨ ਕਰਨਾ ਆਪਣੇ ਬੇਟੇ ਦਾ ਜਨਮ ਦਿਨ ਕਰਨਾ ਮਨਾਉਣਾ ਅਤੇ ਉਹਦੇ ਲਈ ਦੇਖੋ ਮੈਂ ਅਰੇਂਜ ਕਰਨਾ ਮੈਨੂੰ ਸਾਰਾ ਸਮਾਨ ਚਾਹੀਦਾ ਮੈਨੂੰ ਤੁਹਾਡੇ ਰੈਸਟੋਰੈਂਟ ਦਾ ਪਤਾ ਲੱਗਿਆ ਸੀ ਅਤੇ ਮੈਨੂੰ ਚਾਹੀਦੇ ਨੇ ਵੀਹ ਕਿਲੋ ਰਸਗੁੱਲੇ ਦਸ ਕਿਲੋ ਗੁਲਾਬ ਜਾਮੁਨ ਪੰਜ ਕਿਲੋ ਪਕੌੜੇ ਚਾਹੀਦੇ ਨੇ ਮੈਨੂੰ ਬਰੈਡ ਵਾਲੇ ਅਤੇ ਪੰਜ ਕਿਲੋ ਚਾਹੀਦੇ ਨੇ ਮੈਨੂੰ ਪਾਲਕ ਵਾਲੇ ਪਕੌੜੇ ਪੰਜ ਕਿਲੋ ਚਾਹੀਦੇ ਨੇ ਮੈਨੂੰ ਪਨੀਰ ਵਾਲੇ ਪਕੌੜੇ ਅਤੇ ਮੈਨੂੰ ਥੋੜ੍ਹੇ ਕੋਲਡ ਡ੍ਰਿੰਕ ਦੀਆਂ ਬੋਤਲਾਂ ਚਾਹੀਦੀਆਂ ਨੇ ਜਿਹਦੇ ਵਿੱਚ ਕੋਕੋ ਕੋਲਾ ਹੋਵੇ ਜਾਂ ਪੈਪਸੀ ਹੋਵੇ ਕੀ ਇਹ ਤੁਹਾਡੇ ਕੋਲ ਹੈਗੇ ਨੇ ਇੱਥੇ ਇਹਨਾਂ ਨੂੰ ਮੈਨੂੰ ਸ਼ਾਮ ਨੂੰ ਚਾਰ ਵਜੇ ਤੱਕ ਚਾਹੀਦੇ ਨੇ ਕਿਉਂਕਿ ਪੰਜ ਵਜੇ ਅਸੀਂ ਪਾਰਟੀ ਸ਼ੁਰੂ ਕਰਨੀ ਹੈ ਚਾਰ ਵਜੇ ਤੱਕ ਚਾਹੀਦੇ ਹੀ ਚਾਹੀਦੇ ਨੇ ਇੱਕ ਮੈਨੂੰ ਆਪਣੇ ਬੱਚੇ ਦੇ ਲਈ ਕੇਕ ਬਣਵਾਉਣਾ ਹੈ ਉਹ ਵੀ ਚਾਹੀਦਾ ਉਹ ਵੀ ਤੁਹਾਡੇ ਕੋਲ ਅਵੇਲੇਬਲ ਹੋਏਗਾ ਅਤੇ ਮੈਨੂੰ ਇਹ ਵੀ ਦੱਸੋ ਕਿ ਤੁਹਾਡੇ ਕੋਲ ਕੋਈ ਆਫਰ ਚੱਲ ਰਹੀ ਹੋਵੇ ਇਹਨਾਂ ਚੀਜ਼ਾਂ ਦੇ ਉੱਪਰ ਮਤਲਬ ਅਗਰ ਮੈਂ ਇੰਨਾ ਸਮਾਨ ਲੈਂਦੀ ਹਾਂ ਤਾਂ ਕੋਈ ਮੈਨੂੰ ਰਿਆਇਤ ਹੈ ਅਤੇ ਇਹ ਹੈ ਕਿ ਮੈਨੂੰ ਇਹ ਚਾਰ ਵਜੇ ਤੱਕ ਚਾਹੀਦਾ ਕੀ ਤੁਸੀਂ ਚਾਰ ਵਜੇ ਤੱਕ ਅਵੇਲੇਬਲ ਕਰਵਾ ਸਕਦੇ ਹੋ ਕਿਉਂਕਿ ਫਿਰ ਉਸ ਤੋਂ ਬਾਅਦ ਪਾਰਟੀ ਦਾ ਸਾਰਾ ਪ੍ਰਬੰਧ ਵੀ ਕਰਨਾ ਅਤੇ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਜਿਹੜੇ ਚੀਜ਼ ਹੈ ਮੇਰੇ ਘਰ ਪਹੁੰਚਦੀ ਕਰ ਦਿੱਤੀ ਜਾਵੇ